ਮਨੁੱਖ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਅਨੇਕਾਂ ਪ੍ਰਕਾਰ ਦੀਆਂ ਕਸਰਤਾਂ ਜਾਂ ਅਨੇਕਾਂ ਪ੍ਰਕਾਰ ਦੀਆਂ ਕਿਰਿਆਵਾਂ ਕਰਦਾ ਹੈ ਕਸਰਤਾਂ ਦੇ ਵਿੱਚੋਂ ਇੱਕ ਖਾਸ ਅਤੇ ਪੁਰਾਤਨ ਪ੍ਰਣਾਲੀ ਹੈ ਸੋ ਮਨੁੱਖ ਦੌੜਦੇ ਸਮੇਂ ਆਪਣੇ ਧਿਆਨ ਨੂੰ ਕੇਂਦਰਿਤ ਕਰਨ ਦੇ ਲਈ ਆਪਣੇ ਮਨਪਸੰਤ ਦੀ ਕਈ ਵਾਰ ਗੀਤ ਵੀ ਸੁਣਦਾ ਹੈ ਜਿਵੇਂ ਕਿ ਮੈਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਦੌੜ ਪ੍ਰਣਾਲੀ ਨੂੰ ਚੰਗਾ ਮੰਨਦਾ ਹਾਂ ਅਤੇ ਸਟੇਡੀਅਮ ਦੇ ਵਿੱਚ ਜਿਆਦਾਤਰ ਮੈਂ ਦੌੜਨ ਲਈ ਜਾਂਦਾ ਹਾਂ ਤੇ ਉੱਥੇ ਆਪਣੇ ਸੰ ਮਨ ਨੂੰ ਆਪਣੇ ਧਿਆਨ ਨੂੰ ਕੇਂਦਰਿਤ ਕਰਨ ਦੇ ਲਈ ਮੈਂ ਜੋ ਸੰਗੀਤ ਸੁਣਦਾ ਹਾਂ ਉਸਦੇ ਲਈ ਤੁਹਾਡੇ ਨਾਲ ਜਿਹੜਾ ਆਪਣਾ ਅਨੁਭਵ ਸਾਂਝਾ ਕਰ ਰਿਹਾ ਹਾਂ ਤਾਂ ਦੌੜਦੇ ਸਮੇਂ ਜੋ ਮੈਂ ਸੰਗੀਤ ਪਸੰਦ ਕਰਦਾ ਹਾਂ ਉਹ ਹੈ ਜੀ ਜੋ ਮੇਰੇ ਮਨ ਨੂੰ ਹੋਰ ਮੋਟੀਵੇਟ ਕਰਦੇ ਨੇ ਜਿਸ ਤਰ੍ਹਾਂ ਆਪਣੀ ਜਿੱਤ ਵੱਲ ਵੱਧਣ ਦੇ ਲਈ ਆਪਣੀ ਜਾਂ ਮਨ ਨੂੰ ਸ਼ਾਂਤੀ ਦੇਣ ਦੇ ਲਈ ਮੈਂ ਉਹ ਸੰਗੀਤ ਪਸੰਦ ਕਰਦਾ ਹਾਂ ਜਿਸ ਤਰ੍ਹਾਂ ਹਮ ਹੋਗੇ ਕਾਮਯਾਬ ਜਾਂ ਕਲਾਸੀਕਲ ਜੋ ਗਾਣੇ ਹਨ ਮੈਂ ਉਹ ਪਸੰਦ ਕਰਦਾ ਤਾਂ ਕਿ ਮੇਰਾ ਧਿਆਨ ਜਿਹੜਾ ਹੈ ਉਸ ਵੱਲ ਬਣਿਆ ਰਹੇ ਅਤੇ ਮੈਂ ਆਪਣੀ ਨਿਸ਼ਾਨੀ ਨੂੰ ਪ੍ਰਾਪਤ ਕਰ ਸਕਾਂ ਸੋ ਕਲਾਸੀਕਲ ਜਾਂ ਮਨ ਨੂੰ ਹੁਲਾਰਾ ਦੇਣ ਵਾਲੇ ਆਪਣੀ ਜਿੱਤ ਵੱਲ ਆਪਣੀ ਨਿਸ਼ਾਨੀ ਵੱਲ ਵਧਣ ਨਾਲ ਸੰਬੰਧਿਤ ਜੋ ਸੰਗੀਤ ਨੇ ਮੈਂ ਉਹ ਸੁਣਨੇ ਪਸੰਦ ਕਰਦਾ ਹਾਂ ਧੰਨਵਾਦ ਜੀ